ਹਾਂਜੀ ਮੈਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜਿਸਨੇ ਮੈਨੂੰ ਬੌਧਿਕ ਤੌਰ 'ਤੇ ਚੁਣੌਤੀ ਦਿੱਤੀ ਸੀ ਇਸ ਕਿਤਾਬ ਦਾ ਨਾਮ ਸੀ ਦ ਵਿਸ਼ਲਿਸਟ ਇਹ ਇੱਕ ਨੋਵਲ ਸੀ ਜਿਸ ਨੂੰ ਪੜ੍ਹ ਕੇ ਮੈਂ ਆਪਣੇ ਮੈਨੂੰ ਇੱਕ ਤਰ੍ਹਾਂ ਨਾਲ ਇਹ ਲੱਗਿਆ ਕਿ ਸੱਚਮੁੱਚ ਦੇ ਵਿੱਚ ਇਹ ਚੀਜ਼ਾਂ ਲਾਈਫ ਦੇ ਵਿੱਚ ਹੋਣੀਆਂ ਚਾਹੀਦੀਆਂ ਆ ਇਹ ਇੱਕ ਇੱਦਾਂ ਦੀ ਸਟੋਰੀ ਸੀ ਜਿਹਦੇ ਵਿੱਚ ਸਾਨੂੰ ਇਹ ਦੱਸਿਆ ਜਾਂਦਾ ਆ ਕਿ ਸਾਨੂੰ ਆਪਣੀਆਂ ਵਿਸ਼ਿਜ਼ ਨੂੰ ਕਦੇ ਵੀ ਮਾਰਨਾ ਨਹੀਂ ਚਾਹੀਦਾ ਅਤੇ ਅਸੀਂ ਜੀਵਨ ਦੇ ਕਿਸੇ ਵੀ ਪੜਾਅ 'ਤੇ ਹੋਈਏ ਤਾਂ ਸਾਨੂੰ ਆਪਣੀਆਂ ਵਿਸ਼ਿਜ਼ ਜਿਹੜੀਆਂ ਆ ਉਹ ਪੂਰੀਆਂ ਕਰਨੀਆਂ ਚਾਹੀਦੀਆਂ ਇਸ ਕਰਕੇ ਜੋ ਔਥਰ ਸੀ ਇਸ ਨੋਬਲ ਦਾ ਉਹਦਾ ਇਹ ਕਹਿਣਾ ਸੀਗਾ ਕਿ ਸਾਨੂੰ ਆਪਣੀਆਂ ਵਿਸ਼ਿਜ਼ ਨਾ ਇੱਕ ਡਾਇਰੀ ਦੇ ਉੱਤੇ ਲਿਖਦੇ ਰਹਿਣਾ ਚਾਹੀਦਾ ਆ ਅਤੇ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਵਿਸ਼ਿਜ਼ ਨੂੰ ਮਰਨ ਨਹੀਂ ਦੇਣਾ ਚਾਹੀਦਾ ਕਿ ਜਦੋਂ ਵੀ ਮੈਨੂੰ ਲੱਗਦਾ ਆ ਕਿ ਮੈਂ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਵਿੱਚ ਬੈਠੀ ਹਾਂ ਅਤੇ ਕਦੇ ਵੀ ਕਿਤਾਬਾਂ ਦੇ ਬਾਰੇ 'ਚ ਚਰਚਾ ਛਿੜਦੀ ਆ ਤਾਂ ਮੈਂ ਉਹਨਾਂ ਨੂੰ ਹਮੇਸ਼ਾ ਹੀ ਇਸ ਬੁੱਕ ਦੇ ਬਾਰੇ 'ਚ ਦੱਸਦੀ ਹਾਂ ਅਤੇ ਮੈਂ ਹਰ ਇੱਕ ਨੂੰ ਰੈਫਰ ਕਰਦੀ ਹਾਂ ਕਿ ਤੁਸੀਂ ਇਹ ਕਿਤਾਬ ਨੂੰ ਇੱਕ ਵਾਰੀ ਜ਼ਰੂਰ ਪੜਿਓ ਕਿਉਂਕਿ ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਸੱਚਮੁੱਚ ਇਹ ਲੱਗਿਆ ਕਿ ਮੈਨੂੰ ਵੀ ਆਪਣੀਆਂ ਬਹੁਤ ਸਾਰੀਆਂ ਜੋ ਸੱਧਰਾਂ ਆ ਉਹਨਾਂ ਨੂੰ ਮਾਰਨਾ ਨਹੀਂ ਚਾਹੀਦਾ ਸਗੋਂ ਮੈਨੂੰ ਵੀ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਜਿਹੜਾ ਆ ਉਹ ਇੱਕ ਕਦਮ ਚੱਕਣਾ ਚਾਹੀਦਾ ਆ ਸੋ ਮੈਨੂੰ ਲੱਗਦਾ ਆ ਕਿ ਇਹ ਵਾਲੀ ਕਿਤਾਬ ਜਿਹੜੀ ਆ ਮੈਂ ਹਰ ਕਿਸੇ ਨੂੰ ਰੈਫਰ ਕਰ ਸਕਦੀ ਹਾਂ ਕਿ ਉਹ ਪੜ੍ਹਨ ਅਤੇ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਿੱਦਾਂ ਆਪਣੀਆਂ ਵਿਸ਼ਜ਼ ਪੂਰੀਆਂ ਕਰਨੀਆਂ ਚਾਹੀਦੀਆਂ ਆ ਉਹ ਇਹਦੇ ਬਾਰੇ ਵਿੱਚ ਜਾਣ ਸਕਣ ਅਤੇ ਆਪਣੀਆਂ ਵਿਸ਼ਿਜ਼ ਨੂੰ ਪੂਰਾ ਕਰਨ